ਹਾਂਜੀ ਮੈਂ ਆਪਣੇ ਗਣੇਸ਼ ਚਤੁਰਥੀ 'ਤੇ ਆਪਣੇ ਹੱਥਾਂ ਨਾਲ ਆਪਣੀ ਕੁਦਰਤੀ ਮਿੱਟੀ ਨਾਲ ਗਣੇਸ਼ ਜੀ ਦੀ ਮੂਰਤੀ ਬਣਾਈ ਸੀ ਜਿਸਦੇ ਜਿਸ ਦੀ ਡੈਕੋਰੇਸ਼ਨ ਜਿਸ ਦੇ ਰੰਗ ਮੈਂ ਆਪਣੇ ਹੱਥਾਂ ਨਾਲ ਕੀਤੇ ਸੀ ਅੱਜ ਅੱਜ ਦੇ ਸਮੇਂ ਵਿੱਚ ਬਾਜ਼ਾਰ ਵਿੱਚ ਮਿਲਣ ਵਾਲੀ ਮੂਰਤੀ ਪੀ ਓ ਪੀ ਦੀ ਬਣੀ ਹੁੰਦੀ ਹੈ ਜਿਸ ਦੇ ਨਾਲ ਬਹੁਤ ਹੀ ਪ੍ਰਦੂਸ਼ਣ ਹੁੰਦਾ ਹੈ ਅਤੇ ਪਾਣੀ ਨੂੰ ਵੀ ਹਾਨੀ ਹੁੰਦੀ ਹੈ ਇਸ ਲਈ ਮੈਂ ਆਪਣੀ ਕੁਦਰਤੀ ਮੂਰਤੀ ਆਪ ਬਣਾਈ ਸੀ ਤਾਂ ਕਿ ਜਦ ਮੈਂ ਉਹਨੂੰ ਵੀ ਵਿਸਰਜਿਤ ਕਰਾਂ ਅਤੇ ਪਾਣੀ ਦਾ ਵੀ ਕੋਈ ਨੁਕਸਾਨ ਨਾ ਹੋਵੇ